ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਮੈਨੂੰ ਯਾਤਰਾ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਅਤੇ ਮੈਨੂੰ ਜਦੋਂ ਵੀ ਮੌਕਾ ਮਿਲੇ ਮੈਂ ਯਾਤਰਾ ਕਰਨ ਨਿਕਲ ਜਾਂਦੀ ਹਾਂ ਇਸ ਕਰਕੇ ਮੈਂ ਆਪਣੇ ਦੇਸ਼ ਤੋਂ ਬਾਹਰ ਵੀ ਬਹੁਤ ਸਾਰੀਆਂ ਜਗ੍ਹਾਵਾਂ 'ਤੇ ਯਾਤਰਾ ਕੀਤੀ ਹੈ ਜਿਵੇਂ ਕਿ ਆਹ ਪਿੱਛੇ ਜਿਹੇ ਹੀ ਮੈਂ ਯਾਤਰਾ ਕਰਨ ਦੇ ਲਈ ਮਨਾਲੀ ਗਈ ਸਾਂ ਕਿਉਂਕਿ ਮੈਨੂੰ ਪਹਾੜਾਂ ਦੇ ਨਾਲ ਬਹੁਤ ਹੀ ਜ਼ਿਆਦਾ ਲਗਾਓ ਹੈ ਮੈਨੂੰ ਪਹਾੜਾਂ ਵਿੱਚ ਰਹਿਣਾ ਬਹੁਤ ਵਧੀਆ ਲੱਗਦਾ ਹੈ ਪਹਾੜਾਂ ਵਿੱਚ ਰਹਿਣ ਕਰਕੇ ਮੈਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਹੈ ਮੈਂ ਉਸ ਯਾਤਰਾ 'ਤੇ ਗਈ ਸੀ ਮੇਰਾ ਉਦੇਸ਼ ਇਹ ਸੀ ਕਿ ਮੈਂ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਨੂੰ ਜਾਣ ਸਕਾਂ ਉਹਨਾਂ ਦੀਆਂ ਭਾਸ਼ਾ ਨੂੰ ਸਿੱਖ ਸਕਾਂ ਅਤੇ ਜਿਵੇਂ ਦੇ ਉਹ ਪਹਿਰਾਵੇ ਪਾਉਂਦੇ ਹਨ ਉਹ ਮੈਨੂੰ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਹਨ ਮੈਂ ਵੀ ਉਸ ਤਰ੍ਹਾਂ ਦੇ ਪਹਿਰਾਵੇ ਪਾ ਰਹੀ ਸੀ ਜਿੰਨੇ ਦਿਨ ਵੀ ਮੈਂ ਉੱਥੇ ਰਹੀ ਜਿਵੇਂ ਦਾ ਖਾਣਾ ਉਹ ਖਾਂਦੇ ਸੀ ਉਵੇਂ ਦਾ ਖਾਣਾ ਹੀ ਮੈਂ ਖਾ ਰਹੀ ਸੀ ਉਸ ਇਸ ਜਗ੍ਹਾ 'ਤੇ ਜਾਣ ਕਰਕੇ ਬਹੁਤ ਹੀ ਸਾਰੇ ਉਦੇਸ਼ ਸੀ ਉਹਨਾਂ ਦੇ ਖਾਣੇ ਨੂੰ ਸਿੱਖਣਾ ਕਿ ਜਿਵੇਂ ਉਹ ਖਾਣਾ ਬਣਾਉਂਦੇ ਹਨ ਉਹਨਾਂ ਦੀਆਂ ਭਾਸ਼ਾ ਨੂੰ ਸਿੱਖਣਾ ਕਿ ਜਿਵੇਂ ਉਹ ਬੋਲਦੇ ਸਨ ਹੋਰ ਵੀ ਮਨਾਲੀ ਵਿੱਚ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਸਨ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਅਤੇ ਦੂਰ ਦੂਰ ਤੋਂ ਲੋਕ ਉੱਥੇ ਯਾਤਰਾ ਕਰਨ ਆਉਂਦੇ ਹਨ ਉੱਥੇ ਯਾਤਰਾ ਕਰਨ ਦੇ ਨਾਲ ਦਿਲ ਨੂੰ ਤਸੱਲੀ ਮਿਲਦੀ ਹੈ ਅਤੇ ਦਿਲ ਨੂੰ ਬਹੁਤ ਹੀ ਜ਼ਿਆਦਾ ਵਧੀਆ ਮਹਿਸੂਸ ਹੁੰਦਾ ਹੈ ਜਿਸ ਦੇ ਕਾਰਨ ਅਸੀਂ ਆਪਣੀ ਦਿਨ ਦੀ ਜ਼ਿੰਦਗੀ ਦੇ ਵਿੱਚੋਂ ਇੱਕ ਛੋਟਾ ਜਿਹਾ ਹਿੱਸਾ ਕੱਢ ਕੇ ਅਸੀਂ ਯਾਤਰਾ ਦੇ ਵਿੱਚ ਪਾ ਸਕਦੇ ਹਾਂ ਅਤੇ ਇਸ ਯਾਤਰਾ ਦੇ ਬਾਰੇ ਬਾਕੀ ਲੋਕਾਂ ਨੂੰ ਵੀ ਦੱਸ ਸਕਦੇ ਹਾਂ ਧੰਨਵਾਦ ਜੀ